ਪੰਜਾਬ ਵਿੱਚ ਕਈ ਤਰ੍ਹਾਂ ਦੇ ਮੌਸਮ ਹਨ ਜਿਵੇਂ ਕਿ ਗਰਮੀ ਸਰਦੀ ਪਤਝੜ ਅਤੇ ਬਸੰਤ ਮੈਨੂੰ ਬਸੰਤ ਦੀ ਰੁੱਤ ਸਭ ਤੋਂ ਜ਼ਿਆਦਾ ਚੰਗੀ ਲੱਗਦੀ ਹੈ ਇਹ ਰੁੱਤ ਸਰਦੀ ਤੋਂ ਬਾਅਦ ਅਤੇ ਗਰਮੀ ਤੋਂ ਪਹਿਲਾਂ ਵਾਲਾ ਮੌਸਮ ਹੈ ਬਸੰਤ ਰੁੱਤ ਵਿੱਚ ਨਾ ਜ਼ਿਆਦਾ ਗਰਮੀ ਹੁੰਦੀ ਹੈ ਅਤੇ ਨਾ ਹੀ ਜ਼ਿਆਦਾ ਸਰਦੀ ਹੁੰਦੀ ਹੈ ਨਿੱਘੀ ਨਿੱਘੀ ਧੁੱਪ ਵੀ ਚੰਗੀ ਲੱਗਦੀ ਹੈ ਅਤੇ ਕੋਈ ਪਸੀਨਾ ਨਹੀਂ ਆਉਂਦਾ ਕਈ ਥਾਵਾਂ 'ਤੇ ਬਸੰਤ ਰੁੱਤ 'ਤੇ ਮੇਲੇ ਵੀ ਲੱਗਦੇ ਹਨ ਸਾਡੇ ਅੰਮ੍ਰਿਤਸਰ ਵਿੱਚ ਛਿਆਟਾ ਸਾਹਿਬ ਗੁਰਦੁਆਰੇ ਕੋਲ ਬਸੰਤ ਪੰਚਮੀ ਦਾ ਮੇਲਾ ਲੱਗਦਾ ਹੈ ਉਥੇ ਸੰਗਤਾਂ ਦਾ ਬਹੁਤ ਸਾਰਾ ਇਕੱਠ ਹੁੰਦਾ ਹੈ ਅਤੇ ਲੋਕ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਹਨ ਨਾਲ ਹੀ ਉੱਥੇ ਬੱਚਿਆਂ ਦੇ ਵਾਸਤੇ ਝੂਟੇ ਲੱਗੇ ਹੁੰਦੇ ਹਨ ਛੋਟੀਆਂ ਛੋਟੀਆਂ ਦੁਕਾਨਾਂ ਵੀ ਲੱਗੀਆਂ ਹੁੰਦੀਆਂ ਹਨ ਜਿੱਥੋਂ ਕਿ ਲੋਕ ਸਮਾਨ ਖਰੀਦਦੇ ਹਨ ਬੱਚੇ ਇਸ ਮੇਲੇ ਦਾ ਕਾਫੀ ਆਨੰਦ ਮਾਣਦੇ ਹਨ ਬਸੰਤ ਤੇ ਰੁੱਤ ਉੱਤੇ ਪੀਲੇ ਰੰਗ ਦੇ ਕੱਪੜੇ ਪਾਏ ਜਾਂਦੇ ਹਨ ਅਤੇ ਘਰਾਂ ਵਿੱਚ ਪੀਲੇ ਪਕਵਾਨ ਬਣਾਏ ਜਾਂਦੇ ਹਨ ਬਸੰਤ ਰੁੱਤ ਬਾਰੇ ਕਿਹਾ ਜਾਂਦਾ ਹੈ ਆਈ ਬਸੰਤ ਪਾਲਾ ਉਡੰਤ